ਸਕੂਲ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਅਨਾਊਸ ਹੋ ਗਈਆਂ ਸਨ ਗਰਮੀ ਵੀ ਇਸ ਵਾਰ ਕਾਫੀ ਪੈ ਰਹੀ ਸੀ ਦੋ ਚਾਰ ਦੋਸਤ ਅਸੀਂ ਘੁੰਮਦੇ ਫਿਰਦੇ ਬਜ਼ਾਰ ਵਿੱਚ ਜਾ ਰਹੇ ਸੀ ਅਚਾਨਕ ਗੱਲਬਾਤ ਕਰਦੇ ਸਾਡਾ ਕਿਤੇ ਘੁੰਮਣ ਜਾਣ ਦਾ ਪ੍ਰੋਗਰਾਮ ਬਣ ਗਿਆ ਅਸੀਂ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਦਾ ਪ੍ਰੋਗਰਾਮ ਬਣਾਇਆ ਇਹ ਯਾਤਰਾ ਅਸੀਂ ਬੱਸ ਜਾਂ ਕਿਸੇ ਹੋਰ ਸਾਧਨ ਦੀ ਬਜਾਕਿ ਮੋਟਰਸਾਈਕਲਾਂ 'ਤੇ ਜਾਣੀ ਤੈਅ ਕੀਤੀ ਸਾਡੇ ਤਿੰਨ ਚਾਰ ਦੋਸਤ ਹੋਰ ਤਿਆਰ ਹੋ ਗਏ ਅਸੀਂ ਟੋਟਲ ਅੱਠ ਜਣੇ ਸੀ ਚਾਰ ਬਾਈਕ ਅਸੀਂ ਰੈਡੀ ਕਰ ਲਈਆਂ ਇੱਕ ਬਾਈਕ 'ਤੇ ਦੋ ਦੋ ਜਾਣੇ ਜਾਣ ਲਈ ਤਿਆਰ ਹੋ ਗਏ ਸ਼ਨੀ ਐਤਵਾਰ ਦਾ ਦਿਨ ਵਿੱਚ ਮਿਕਸ ਕਰਕੇ ਅਸੀਂ ਬੁੱਧਵਾਰ ਤੱਕ ਵਾਪਸੀ ਦਾ ਪਲੈਨ ਕਰ ਲਿਆ ਸਵੇਰੇ ਚਾਰ ਵਜੇ ਤੜਕੇ ਅਸੀਂ ਉੱਠ ਗਏ ਅਤੇ ਆਪਣੇ ਆਪਣੀਆਂ ਬਾਈਕਾਂ ਸਾਫ਼ ਕਰਕੇ ਅਸੀਂ ਸਵੇਰੇ ਯਾਤਰਾ ਲਈ ਜੀ ਘਰੋਂ ਨਿਕਲ ਗਏ ਮੌਸਮ ਬਹੁਤ ਸੁਹਾਵਣਾ ਸੀ ਸਵੇਰੇ ਅਜੇ ਧੁੱਪ ਨਹੀਂ ਨਿਕਲੀ ਸੀ ਹਲਕੀ ਹਲਕੀ ਠੰਡਕ ਮਹਿਸੂਸ ਹੋ ਰਹੀ ਸੀ ਆਪਸ 'ਚ ਗੱਲਾਂ ਬਾਤਾਂ ਕਰਦੇ ਇੱਕ ਦੂਜੇ ਦੇ ਨਾਲ ਅੱਗੇ ਪਿੱਛੇ ਜਾਂਦੇ ਜਾਂਦੇ ਅਸੀਂ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰ ਗਏ ਹੌਲੀ ਹੌਲੀ ਸਭ ਤੋਂ ਪਹਿਲਾਂ ਅਸੀਂ ਯਾਤਰਾ ਦਾ ਇੰਨਜੋਏ ਕਰਦੇ ਹੋਏ ਸ਼੍ਰੀਨਗਰ ਗੜਵਾਲ ਪਹੁੰਚੇ